ਹੈਲੋ ਨਮਸਕਾਰ ਜੀ ਇਹ ਸਿੱਖਿਆ ਦੇ ਰੋਜ਼ਗਾਰ ਤੇ ਲੀਡਰਾਸ਼ਿਪਾਂ ਦੇ ਰੂਪ ਦੇ ਵਿੱਚ ਗੁਰਦਾਸਪੁਰ ਹੈ ਗੁਰਦਾਸਪੁਰ ਜਿਲੇ ਦੇ ਨੌਜਵਾਨ ਹਨ ਇਹ ਬਹੁਤ ਹੀ ਆਲਸੀ ਸੁਭਾਅ ਦੇ ਬਣ ਜਾਂਦੇ ਹਨ ਤੇ ਵਿਹਲੇ ਰਹਿਣ ਦੇ ਕਰਕੇ ਨੌਕਰੀ ਨੂੰ ਆਪਣੇ ਆਪ ਨੂੰ ਚੁਣੌਤੀਆਂ ਦਿੰਦੇ ਹਨ ਕਿਉਂਕਿ ਆਲਸ ਤਾਂ ਬਹੁਤ ਸਭ ਤੋਂ ਪਹਿਲਾਂ ਹੀ ਜਿਆਦਾ ਕਰਦੇ ਆ ਜੇ ਆਲਸ ਨਾ ਕਰਨ ਆਪਣੀ ਉਦਮ ਕਰਨ ਪੜਨ ਉਧਰ ਜਾਨ ਤੇ ਫਿਰ ਹੀ ਕਰ ਸਕਦੇ ਹਨ ਨੌਕਰੀ ਇਹਨਾਂ ਦੇ ਵਿੱਚ ਆਪਣੀ ਹਿੰਮਤ ਨਹੀਂ ਕਰਦੇ ਤੇ ਫਿਰ ਬਾਂ ਘਰ ਬੈਠੇ ਰਹਿੰਦੇ ਹੈ ਕਦੀ ਮੋਬਾਇਲ ਚਲਾਉਂਦੇ ਆ ਪੇਰੈਂਟਸ ਨੂੰ ਤੰਗ ਕਰਦੇ ਹੈ ਆਪਣੇ ਵੱਲ ਨੂੰ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਆਪਾਂ ਕਿਸ ਮੁਕਾਮ ਤੇ ਪਹੁੰਚਣਾ ਹੈ ਆਪਣੇ ਮੁਕਾਮ ਤੇ ਪਹੁੰਚਣ ਦਾ ਕੋਈ ਇਹਨਾਂ ਕੋਲ ਆਈਡੀਆ ਈ ਨੀ ਹੈਗਾ ਆਈਡੀਆ ਬੱਚਾ ਲਗਾਏਗਾ ਤੇ ਤਾਂ ਹੀ ਇਨਕੇ ਪ੍ਰੋਬਲਮ ਹੱਲ ਹੋਏਗੀ ਤੇ ਫਿਰ ਆਪਣੀਆਂ ਸਰੀਰਾਂ ਨੂੰ ਬਿਮਾਰੀਆਂ ਲਾਣੀਆਂ ਅੰਦਰ ਬੈਠ ਕੇ ਵਿਹਲੇ ਫਿਰ ਸੋਚਦੇ ਰਹਿੰਦੇ ਹੈ ਫਿਰ ਇਹਨਾਂ ਦੇ ਦਿਮਾਗ ਤੇ ਬ ਬਾਰਡਨ ਪਿਆ ਰਹਿੰਦਾ ਵਾ ਕੀ ਅਸੀਂ ਸਾਨੂੰ ਨੌਕਰੀ ਨੂੰ ਮਿਲਦੀ ਨੌਕਰੀ ਨਹੀਂ ਮਿਲਦੀ ਨੌਕਰੀ ਤੇ ਤਾਂ ਹੀ ਮਿਲੇਗਾ ਅਗਰ ਤੁਸੀਂ ਉਦਮ ਕਰੋਗੇ ਪੜੋਗੇ ਕੁਛ ਕੁਛ ਬਣੋਗੇ ਬਣਨ ਵਾਸਤੇ ਤੇ ਤੁਹਾਨੂੰ ਅੱਗੇ ਤੁਰਨਾ ਪੈਣਾ ਹੈ ਅਗਰ ਤੁਸੀਂ ਕੋਈ ਕਿਸੇ ਵੀ ਲਾਈਨ ਤੇ ਜਾਓਗੇ ਪਹਿਲੇ ਤੁਹਾਨੂੰ ਮਿਹਨਤ ਕਰਨ ਦੀ ਲੋੜ ਹੈ ਅਗਰ ਬੱਚੇ ਤੁਸੀਂ ਮਿਹਨਤ ਕਰੋਗੇ ਤੇ ਤਾਂ ਹੀ ਅਗਾਹ ਜਾ ਸਕਦੇ ਹਨ ਤੇ ਜਦ ਇਹਨਾਂ ਨੇ ਮਿਹਨਤ ਹੀ ਨਹੀਂ ਕਰਨੀ ਤੇ ਇਹਨਾਂ ਨੇ ਅੱਗੇ ਨਹੀਂ ਜਾਣਾ ਫਿਰ ਕਹਿਣਾ ਕੀ ਗੁਰਦਾਸਪੁਰ ਡਿਸਟਰਿਕਟ ਮਾੜਾ ਹੈ ਮਾੜਾ ਨੀ ਹੈ ਕੋਈ ਵੀ ਨਹੀਂ ਹੈ ਇਹ ਆਪ ਆਪਣਾ ਭਵਿੱਖ ਆਪ ਖਰਾਬ ਕਰਦੇ ਹਨ ਕਿਉਂਕੀ ਇਹਨਾਂ ਨੂੰ ਪਤਾ ਨੀ ਹੈਗੈ ਕੀ ਭਵਿੱਖ ਦੇ ਵਿੱਚ ਕੀ ਅੱਗੇ ਜਾਣ ਵਾਸਤੇ ਥੋਨੂੰ ਉੱਦਮ ਕਰਨਾ ਪੈਂਦਾ ਹੈ ਅਗਰ ਉੱਦਮ ਕਰਾਂਗੇ ਤੇ ਫਿਰ ਹੀ ਅਸੀਂ ਅੱਗੇ ਚੱਲ ਪਾਵਾਂਗੇ ਨਾ ਜੇ ਸਾਡੇ ਵਿੱਚ ਹਿੰਮਤ ਨਹੀਂ ਹੈ ਅਸੀਂ ਹਿੰਮਤ ਹਾਰ ਕੇ ਬੈਠ ਜਾਂਦੇ ਆਂ ਤੇ ਫਿਰ ਆਪਾਂ ਬਿਲਕੁਲ ਨਜਾਇਜ਼ ਕੰਮਾਂ ਦੇ ਵੱਲ ਪੈ ਜਾਈਦਾ ਇਹ ਸਾਡੇ ਬਿਲਕੁਲ ਆਪਾਂ ਨਜਾਇਜ਼ ਕੰਮਾਂ ਨੂੰ ਪ੍ਰੈਫਰੈਂਸ ਦੇਣ ਲੱਗ ਪੈਂਦੇ ਆ ਆਪਣੇ ਪੇਰੈਂਟਸ ਨਾਲ ਮਾੜਾ ਚੰਗਾ ਬੋਲਣ ਡੇ ਲੈ ਪੈਂਦੇ ਹਨ ਇਹ ਸਾਡਾ ਸਾਰਾ ਕਸੂਰ ਕੀ ਹੈ ਕਿ ਸਾਨੂੰ ਆਪਣੇ ਆਪ ਨੂੰ ਆਲਸ ਦੇ ਵਿੱਚ ਆਪਣੇ ਆਪ ਨੂੰ ਡਿਪਰੈਸ਼ਨ ਦੇ ਵਿੱਚ ਰੱਖਣੇ ਆ ਆਪਣੇ ਆਪ ਨੂੰ ਉਹਨੂੰ ਕਿਸੇ ਦੇ ਥਰੂ ਨੀ ਸਮਝਦੇ ਜੇ ਆਪਾਂ ਮਤਲਬ ਉਹ ਇਸੇ ਹੀ ਸਰੀਰ ਨੂੰ ਅੱਗੇ ਲੈ ਕੇ ਤੁਰੀਏ ਤੇ ਆਪਾਂ ਕਿਸੇ ਮੁਕਾਮ ਤੇ ਜਾ ਪਹੁੰਚਦੇ ਹਨ ਥੈਂਕਯੂ